ਇੱਥੇ ਪੰਜਾਬ 'ਚ ਜ਼ਿਆਦਾਤਾਰ ਲੋਕ ਆਪਣੀਆਂ ਛੱਤਾਂ 'ਤੇ ਜਿਵੇਂ ਦਾਣਾ ਜ਼ਰੂਰ ਪਾਉਂਦੇ ਨੇ ਅਤੇ ਜੇ ਰੋਟੀ ਹੁੰਦੀ ਹੈ ਰੋਟੀ ਥੱਲੇ ਕੁੱਤਿਆਂ ਨੂੰ ਤਾਂ ਪਾਉਂਦੇ ਹੀ ਪਾਉਂਦੇ ਨੇ ਜਾਨਵਰਾਂ ਨੂੰ ਤਾਂ ਪਾਉਂਦੇ ਹੀ ਪਾਉਂਦੇ ਨੇ ਨਾਲ ਪੰਛੀਆਂ ਨੂੰ ਜ ਪੰਛੀਆਂ ਨੂੰ ਵੀ ਜ਼ਰੂਰ ਪਾਉਂਦੇ ਨੇ ਅਤੇ ਪੰਜਾਬ ਦੇ ਲੋਕ ਦਾਨੀ ਜ਼ਿਆਦਾ ਹੋਣ ਕਰਕੇ ਇਨ੍ਹਾਂ ਨੂੰ ਇਹ ਚੀਜ਼ ਕਰਨੀ ਮਤਲਬ ਇੱਕ ਤਰ੍ਹਾਂ ਦੀ ਪਸੰਦ ਦੀ ਹੁੰਦੀ ਹੈ ਅਤੇ ਜਿਵੇਂ ਪੰਛੀ ਨੇ ਇਨ੍ਹਾਂ ਨੂੰ ਪਾਣੀ ਹੋ ਗਿਆ ਇਹ ਰੱਖਣਾ ਤਾਂ ਆਪਣਾ ਇੱਕ ਤਰ੍ਹਾਂ ਦਾ ਫਰਜ਼ ਹੀ ਹੁੰਦਾ ਵੀ ਹਾਂ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਜਾ ਕੇ ਸ਼ੁੱਧ ਪਾਣੀ ਮਿਲਣਾ ਜਾਂ ਉਹ ਕਰਨਾ ਉਹ ਮੁਸ਼ਕਿਲ ਹੋ ਗਿਆ ਅੱਜ ਕੱਲ੍ਹ ਦੇ ਟਾਈਮ 'ਚ ਕਿਉਂਕਿ ਕੋਈ ਵੀ ਇੱਥੇ ਆਪਣੇ ਪੀਣ ਯੋਗ ਪਾਣੀ ਹੈ ਜਿਹੜਾ ਉਹ ਵੀ ਸ਼ੁੱਧ ਨਹੀਂ ਹੈਗਾ ਅਤੇ ਜੇ ਆਪਾਂ ਉਨ੍ਹਾਂ ਨੂੰ ਆਪਣਾ ਰੱਖਾਂਗੇ ਪਾਣੀ ਰੱਖਾਂਗੇ ਜਾਂ ਅਨਾਜ ਕੁਛ ਵੀ ਰੱਖਾਂਗੇ ਤਾਂ ਉਹਦੇ ਲਈ ਮੈਂ ਕਹਿੰਦਾ ਜੀ ਆਪਣਾ ਹੀ ਫਾਇਦਾ ਕਿ ਆਪਣਾ ਜਿਹੜਾ ਆਸਮਾਨ ਆ ਉਹ ਪੰਛੀਆਂ ਨਾਲ 'ਤੇ ਭਰਿਆ ਰਹੂਗਾ ਨਹੀਂ ਤਾਂ ਕਈ ਪੰਛੀ ਇਹੋ ਜਿਹੇ ਨੇ ਜਿਹੜੇ ਅੱਜ ਕੱਲ੍ਹ ਦੇ ਟਾਈਮ 'ਚ ਲੱਭਦੇ ਹੀ ਨਹੀਂ ਹੈਗੇ ਦਿਸਦੇ ਹੀ ਨਹੀਂ ਹੈਗੇ ਅਤੇ ਹੁਣ ਪੰਛੀ ਵੀ ਆਪਣਾ ਬਹੁਤ ਘੱਟ ਹੋ ਗਏ ਨੇ ਜੇ ਇਹ ਚੀਜ਼ਾਂ ਆਪਾਂ ਕਰਦੇ ਰਵਾਂਗੇ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਆਪਾਂ ਬਚਾ ਸਕਦੇ ਹਾਂ